ਹੈਲੋ ਹਾਂਜੀ ਤੁਸੀਂ ਪਾਰਲਰ ਤੋਂ ਬੋਲ ਰਹੇ ਹੋ ਜੀ ਹਾਂਜੀ ਮੈਮ ਮੈਂ ਬਾਲ ਕਰਵਾਉਣੇ ਸੀ ਜੀ ਅਸੀਂ ਪਾਰਟੀ 'ਤੇ ਜਾਣਾ ਸੀ ਜੀ ਮੈਂ ਜੀ ਮੇਰਾ ਨਾ ਮੂੰਹ ਗੋਲ ਆ ਮੈਂ ਤਾਂ ਕਰਕੇ ਉਹ ਕਰਨਾ ਗਾ ਵੀ ਮੇਰੇ ਕਿਹੜਾ ਸਟਾਇਲ ਜਚੁਗਾ ਜੀ

ਕਿੰਨੀ ਕੁ ਰੇਂਜ ਤੱਕ ਆ ਜੀ ਅੱਛਾ ਜੀ ਫਿਰ ਜੀ ਮੈਂ ਵੀ ਬਾਲ ਧੋ ਕੇ ਆਵਾਂ ਕਿ ਵੀ ਘਰ ਧੋਣੇ ਪੈਣੇਗੇ ਕਿ ਇੱਥੇ ਦੁਕਾਨ 'ਤੇ ਹੀ ਜੀ ਅੱਛਾ ਜੀ ਹੋਰ ਜੀ ਮੈਡਮ ਦਾ ਸੁਭਾਅ ਠੀਕ ਹੈ ਜੀ ਰੁੱਖੇ ਜੇ ਤਾਂ ਨਹੀਂ ਹੈਗੇ ਜੀ ਮੈਡਮ ਅੱਛਾ ਜੀ ਮੈਂ ਫੇਰ ਕਿੰਨੇ ਕੁ ਵਜੇ ਆਵਾਂ ਜੀ ਅਸੀਂ ਸਵੇਰੇ ਦਸ ਵਜੇ ਜਾਣਾ ਹੈਗਾ ਜੀ ਅੱਛਾ ਜੀ ਫਿਰ ਅੱਛਾ ਜੀ ਅੱਛਾ ਜੀ ਮੈਂ ਇੰਨੀ ਖੂਬਸੂਰਤ ਲੱਗਣੀ ਚਾਹੀਦੀ ਹੈ ਕਿ ਸਾਰੇ ਦੇਖਦੇ ਰਹਿ ਜਾਣ ਜੀ ਅਸੀਂ ਨਾ ਪਾਰਟੀ 'ਤੇ ਜਾਣਾ ਜੀ ਅੱਛਾ ਜੀ ਮੇਰੇ ਨਾ ਇੱਕ ਬਾਲ ਬਹੁਤ ਛੋਟੇ ਨੇ ਮੇਰੇ ਨਾ ਪਮਪ ਪਫ ਵੀ ਨਹੀਂ ਹੁੰਦਾ ਹੈਗਾ ਜਦ ਮੈਂ ਪਮ ਕਰਦੀ ਹਾਂ ਜਾਂ ਮੈਂ ਮਿੱਡੀਆਂ ਵਗੈਰਾ ਕੁਛ ਵੀ ਕਰਦੀ ਹਾਂ ਨਾ ਮੇਰੇ ਪਮ ਵੀ ਨਹੀਂ ਹੁੰਦਾ ਹੈਗਾ ਵੀ ਮੇਰੇ ਬਾਲ ਨਾ ਟੁੱਟੇ ਜੇ ਬਹੁਤ ਜ਼ਿਆਦਾ ਪਏ ਨੇ ਅੱਛਾ ਜੀ ਹੋਰ ਜੀ ਮੈਡਮ ਵਧੀਆ ਜੀ ਸਭਾਅ ਸਵੂਹ ਵਧੀਆ ਮੈਡਮ ਦਾ ਜੀ ਅੱਛਾ ਜੀ ਫਿਰ ਜੀ ਮੈਂ ਵੀ ਜੂੜੇ ਦੇ ਨਾਲ ਨਾਲ ਮੈਂ ਮੇਕਅਪ ਵੀ ਕਰਵਾਉਣਾ ਚਾਹੁੰਦੀ ਹਾਂ ਨਾ ਫੇਸ਼ੀਅਲ ਵਗੈਰਾ ਮ ਸਾਰੀ ਤਿਆਰ ਹੋਣਾ ਚਾਹੁੰਦੀ ਹਾਂ ਜੀ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਫਿਰ ਅੱਛਾ ਜੀ ਜੀ ਫਿਰ ਤਿਆਰ ਹੋਈ ਦੇ ਤਾਂ ਅਲੱਗ ਅਲੱਗ ਪੈਸੇ ਹੋਣਗੇ ਜੀ ਅੱਛਾ ਜੀ ਕਿੰਨੇ ਕੁ ਰੇਂਜ ਤੱਕ ਪੈ ਜਾਣਗੇ ਜੀ ਵਿੱਚ ਹੀ ਬਾਲਾਂ ਦਾ ਵਿੱਚ ਹੀ ਵੀ ਮੇਕਅਪ ਕਰਾਈ ਦਾ ਅੱਛਾ ਜੀ ਠੀਕ ਠੀਕ ਆ ਜੀ ਦਨਿਆਵਾਦ ਮੈਡਮ ਜੀ ਅੱਛਾ ਜੀ ਠੀਕ ਹੈ ਮੈਡਮ ਜੀ ਫਿਰ ਮੈਂ ਸੁਭਾਹ ਆ ਜੂੰਗੀ ਦਸ ਵਜੇ ਦਨਿਆਵਾਦ ਧੰਨਵਾਦ ਮੈਡਮ ਜੀ ਥੈਂਕ ਯੂ ਥੈਂਕ ਯੂ ਮੈਡਮ ਜੀ